ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਹਨ ਮੈਂ ਯਾਨੀ ਜਿਹਨਾਂ ਸਕੀਮਾਂ ਦਾ ਹੁਣ ਤੱਕ ਲਾਭ ਲਿਆ ਹੈ ਉਹਨਾਂ ਦੇ ਵਿੱਚੋਂ ਹੈਗੇ ਆ ਸਲਾਂ ਗੈਸ ਸਲੰਡਰਾਂ ਦੀ ਅਤੇ ਗੈਸ ਸਿਲਿੰਡਰ ਜਿਵੇਂ ਆਮ ਸਾਨੂੰ ਸਾਢੇ ਅੱਠ ਸੌ ਦਾ ਮਿਲਦਾ ਹੈ ਸਰਕਾਰ ਰਾਹੀਂ ਮਿਲਦਾ ਹੈ ਸਬਸਿਡੀ ਸਾਢੇ ਤਿੰਨ ਤਿੰਨ ਸੌ ਵੀਹ ਰੁਪਏ ਮਿਲ ਜਾਂਦੀ ਆ ਥੋੜ੍ਹਾ ਜਿਹਾ ਫਾਇਦੇ 'ਚ ਹੋ ਜਾਂਦਾ ਬਾਕੀ ਸਕੂਲ ਦੇ ਵਿੱਚ ਵੀ ਸਰਕਾਰੀ ਦੇ ਵਿੱਚ ਬੱਚੇ ਲਾਏ ਹੋਏ ਨੇ ਪੜ੍ਹਨ ਉੱਥੇ ਵੀ ਉਹਨਾਂ ਨੂੰ ਕਿਤਾਬਾਂ ਯੂਨੀਫਾਰਮ ਵਗੈਰਾ ਮਿਲ ਜਾਂਦੀ ਆ ਅਤੇ ਜੇ ਬੱਚੇ ਥੋੜ੍ਹੇ ਜਿਹੇ ਇੰਟੈਲੀਜੈਂਟ ਨੇ ਉਹਨਾਂ ਨੂੰ ਸਲਾਨਾ ਵਜੀਫਾ ਵੀ ਦਿੰਦੇ ਨੇ ਅਤੇ ਫੀਸਾਂ ਵੀ ਘੱਟ ਕਰ ਦਿੰਦੇ ਨੇ ਬਾਕੀ ਸਰਕਾਰ ਨੇ ਜੋ ਕਣਕ ਦੀ ਸਕੀਮ ਚਲਾਈ ਹੋਈ ਉਹ ਵੀ ਤਿੰਨ ਮਹੀਨੇ ਬਾਅਦ ਸਾਨੂੰ ਕਣਕ ਮਿਲਦੀ ਆ ਉਹਦੇ ਨਾਲ ਵੀ ਕਾਫੀ ਹੰਦਾ ਲੱਗ ਜਾਂਦਾ ਇਹ ਘਰਾਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਕੰਮ ਕਾਰ ਥੋੜ੍ਹੇ ਜਿਹੇ ਠੀਕ ਜਿਹੇ ਹੀ ਨੇ ਅਤੇ ਸ਼ਗਨ ਸਕੀਮ ਵੀ ਹੈਗੀ ਆ ਉਹਦਾ ਵੀ ਮੈਂ ਥੋੜ੍ਹਾ ਬਹੁਤਾ ਲਾਭ ਲੈ ਹੀ ਲੈਂਦੀ ਹਾਂ ਸੁਵਿਧਾ ਕੇਂਦਰ ਜਾ ਕੇ ਫਾਰਮ ਵਗੈਰਾ ਭਰ ਕੇ ਜੋ ਵੀ ਯਾਨੀ ਕਿ ਸਰਕਾਰ ਵੱਲੋਂ ਸਕੀਮਾਂ ਆਉਂਦੀਆਂ ਨੇ ਮੈਂ ਪੁੱਛਗਿੱਛ ਕੇ ਮਾੜਾ ਮੋਟਾ ਆਪਣਾ ਲਾਭ ਕਾਫੀ ਲੈ ਰਹੀ ਹਾਂ ਅਤੇ ਸਰਕਾਰ ਦਾ ਬਹੁਤ ਧੰਨਵਾਦ ਆ